ਅਖ਼ਬਾਰ ਵਿੱਚ ਸਾਨੂੰ ਬਹੁਤ ਸਾਰੀ ਖ਼ਬਰਾਂ ਸਨਸਨੀ ਵਾਲੀ ਮਿਲਦੀਆਂ ਹਨ ਜਿਨ੍ਹਾਂ 'ਚ ਗੱਲ ਝੂਠ ਲਿਖੀ ਹੁੰਦੀ ਆ ਅਤੇ ਜਦੋਂ ਬਾਅਦ 'ਚ ਪਤਾ ਚੱਲਦੀ ਆ ਕਿ ਗੱਲ ਕੁਛ ਹੋਰ ਸੀਗੀ ਫੇਰ ਸਾਰੇ ਉਹ ਗੱਲ ਦਾ ਮਜ਼ਾਕ ਉਡਾਉਂਦੇ ਹੈ ਅਤੇ ਅਖ਼ਬਾਰ ਵਾਲੇ ਝੂਠ ਕਹਿੰਦੇ ਹੈ ਕਦੇ ਵੀ ਅਖ਼ਬਾਰ ਦੀ ਗੱਲਾਂ 'ਤੇ ਉਹ ਨਹੀਂ ਕਰਨਾ ਚਾਹੀਦਾ ਹੈ